ਆਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਬੱਚਿਆਂ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਇਹਨਾਂ ਦੇ ਦੁਆਰਾ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਇਸ ਦੁਆਰਾ ਬੱਚੇ ਘਰ ਬੈਠੇ ਹੀ ਆਪਣੀ ਪੜ੍ਹਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰੱਖ ਸਕਦੇ ਹਨ ਸਾਡੇ ਦੇਸ਼ ਵਿੱਚ ਕੁਝ ਬੱਚੇ ਅਜਿਹੇ ਹਨ ਜਿਹੜਾ ਆਨਲਾਈਨ ਪੜ੍ਹਾਈ ਅਤੇ ਗਲਤ ਵਰਤੋਂ ਕਰਦੇ ਹਨ